ਜੀ ਹਾਂ ਸਾਡੇ ਕੋਲ ਐਲ ਪੀ ਜੀ ਦਾ ਕਨੈਕਸ਼ਨ ਸਲੰਡਰ ਹੈਗਾ ਬਹੁਤ ਸੁੱਖ ਹੈ ਸਾਨੂੰ ਇਹ ਸਲੰਡਰ ਦਾ ਹੁਣ ਪੰਜਾਬ ਸਾਡਾ ਜਿਹੜਾ ਏ ਬਹੁਤ ਅੱਗੇ ਜਾ ਚੁੱਕਾ ਏ ਬਹੁਤ ਸਹੂਲਤਾਂ ਨੇ ਹੁਣ ਜਿਸ ਤਰ੍ਹਾਂ ਅਸੀਂ ਘਰ ਬੈਠੇ ਹੀ ਸਲੰਡਰ ਨੂੰ ਘਰ ਆਉਂਦੇ ਸਾਡੇ ਘਰ ਤੱਕ ਪਹੁੰਚਾਇਆ ਜਾਂਦਾ ਏ ਸਲੰਡਰ ਅਸੀਂ ਫਟਾਫਟ ਆਪਣਾ ਕੋਈ ਵੀ ਕੰਮ ਕਰਨਾ ਹੋਵੇ ਜਲਦੀ ਜਲਦੀ ਕਰ ਲੈਂਦੇ ਹਾਂ ਚਾਹ ਬਣਾਉਣੀ ਹੋਵੇ ਰੋਟੀ ਬਣਾਉਣੀ ਹੋਵੇ ਫਟਾਫਟ ਕੰਮ ਸਮੇਟ ਲੈਂਦੇ ਹਾਂ ਪਰ ਜਦੋਂ ਇਹ ਸਲੰਡਰ ਨਹੀਂ ਸੀਗੇ ਹੈਗੇ ਸਾਡੇ ਬਜ਼ੁਰਗਾਂ ਦੇ ਟਾਈਮ ਉਹਨਾਂ ਨੂੰ ਬਹੁਤ ਔਖਾ ਸੀ ਇਸ ਤਰ੍ਹਾਂ ਉਹਨਾਂ ਪਹਿਲਾਂ ਵਿਚਾਰਿਆਂ ਨੇ ਬਾਲਣ ਇਕੱਠਾ ਕਰਨਾ ਲੱਕੜੀਆਂ ਪਾਥੀਆਂ ਸੁਕਾਉਣੀਆਂ ਬਾਲਣ ਨੂੰ ਸੁਕਾਉਣਾ ਘਰ ਵਿੱਚ ਚੁੱਲ੍ਹਾ ਬਣਾਉਣਾ ਉਹਨੂੰ ਬਣਾਉਣਾ ਮਿੱਟੀ ਨਾਲ ਉਹਨੂੰ ਸੁਕਾਉਣਾ ਫਿਰ ਉਹਨਾਂ ਨੇ ਅੱਗ ਬਾਲਣੀ ਚਾਹ ਬਣਾਉਣੀ ਕਿੰਨਾਂ ਟਾਈਮ ਲੱਗਦਾ ਸੀਗਾ ਹੁਣ ਤਾਂ ਮਿੰਟੋ ਮਿੰਟ ਇਹ ਸਾਡੀ ਗੈਸ 'ਤੇ ਚਾਹ ਬਣ ਜਾਂਦੀ ਹੈ ਬਹੁਤ ਵਧੀਆ ਬਹੁਤ ਸੁੱਖ ਹੈ ਹੁਣ ਇਹਦਾ ਐਲ ਪੀ ਜੀ ਸਲੰਡਰ ਦਾ ਪਹਿਲਾਂ ਵਾਸਤੇ ਬਹੁਤ ਮੁਸ਼ਕਲ ਸੀਗਾ ਚੁੱਲ੍ਹੇ ਵਾਸਤੇ ਜਿਹਨਾਂ ਨੇ ਚੁੱਲ੍ਹੇ 'ਤੇ ਕੰਮ ਕਰਨਾ ਸੀਗਾ ਉਹਨਾਂ ਦੀਆਂ ਅੱਖਾਂ ਵਿੱਚ ਧੂੰਆਂ ਵੀ ਪੈਂਦਾ ਸੀ ਅੱਖਾਂ ਦੇ ਨੁਕਸਾਨ ਵੀ ਹੁੰਦੇ ਸੀਗੇ ਬਹੁਤ ਸਾਰੇ ਪਰ ਹੁਣ ਫਾਇਦਾ ਤਾਂ ਬਹੁਤ ਹੈ ਐਲ ਪੀ ਜੀ ਸਲੰਡਰ ਦਾ ਪਰ ਹੁਣ ਜਿਸ ਤਰ੍ਹਾਂ ਹੁਣ ਇਹਨਾਂ ਦੇ ਰੇਟ ਵੱਧ ਰਹੇ ਨੇ ਬਹੁਤ ਜ਼ਿਆਦਾ ਵੱਧ ਗਿਆ ਰੇਟ ਪਹਿਲਾਂ ਚਲੋ ਠੀਕ ਸੀਗਾ ਹਰ ਕੋਈ ਲੈਂਦਾ ਸੀਗਾ ਪਰ ਹੁਣ ਹੌਲੀ ਹੌਲੀ ਫਿਰ ਲੋਕ ਚੁੱਲ੍ਹਿਆਂ 'ਤੇ ਹੀ ਆਉਣ ਦੇ ਨੇ ਇਸ ਕਰਕੇ ਇਹ ਐਲ ਪੀ ਜੀ ਸਲੰਡਰ ਦੇ ਬਹੁਤ ਫਾਇਦੇ ਨੇ